ਨਵੇਂ ਸਾਲ ਦੀ ਸੇਲ ਵਿੱਚ ਮੈਂ ਦੋ ਪਲਾਸਟਿਕ ਦੇ ਕੰਟੇਨਰ ਔਨਲਾਈਨ ਮੰਗਵਾਏ ਉਸ ਵੇਲੇ ਸੇਲ ਸੱਠ ਪਰਸੈਂਟ ਦੇ ਆਸ ਪਾਸ ਸੀ ਅਤੇ ਮੈਂ ਜਦੋਂ ਇੱਕ ਤਾਂ ਮੈਨੂੰ ਉਹ ਡਿਲੀਵਰੀ ਬੜੀ ਲੇਟ ਮੈਨੂੰ ਪਹੁੰਚੀ ਅਤੇ ਜਦੋਂ ਡਿਲੀਵਰੀ ਪਹੁੰਚੀ ਤਾਂ ਮੈਂ ਦੇਖ ਕੇ ਬੜੀ ਹੈਰਾਨ ਹੋਈ ਕਿ ਦੋਵੇਂ ਕੰਟੇਨਰ ਪਲਾਸਟਿਕ ਦੇ ਟੁੱਟੇ ਹੋਏ ਸੀ ਅਤੇ ਜਦੋਂ ਮੈਂ ਉਹਦੇ ਵਿੱਚ ਸਮਾਨ ਪਾਇਆ ਅਤੇ ਉਹ ਸਮਾਨ ਲਿਕ਼ੁਆਡ ਮੈਂ ਉਹਦੇ ਵਿੱਚ ਪਾਇਆ ਅਤੇ ਉਹ ਦੇਖਿਆ ਕਿ ਉਹ ਲੀਕ ਵੀ ਕਰ ਰਹੇ ਸਨ ਜਿਸ ਨੂੰ ਵੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਅਤੇ ਮੈਂ ਚਾਹੁੰਦੀ ਹਾਂ ਕਿ ਮੇਰੇ ਉਹ ਦੋਨੋਂ ਕੰਟੇਨਰ ਵਾਪਸ ਬਦਲ ਦਿੱਤੇ ਜਾਣ ਨਹੀਂ ਤਾਂ ਮੇਰੇ ਪੈਸੇ ਮੈਨੂੰ ਵਾਪਸ ਦਿੱਤੇ ਜਾਣ ਸੇਲ ਦੇ ਸਿਕਸਟੀ ਪਰਸੈਂਟ ਵੇਖ ਕੇ ਮੈਂ ਪ੍ਰੋਡਕਟ ਮੰਗਵਾ ਤਾਂ ਲਿਆ ਪਰ ਮੈਨੂੰ ਉਹਦਾ ਬੜਾ ਹੀ ਬੈਡ ਐਕਸਪੀਰੀਅੰਸ ਹੋਇਆ ਜਿਸ ਲਈ ਮੈਂ ਚਾਹੁੰਦੀ ਹਾਂ ਕਿ ਮੇਰੇ ਦੋਨੋਂ ਕੰਟੇਨਰ ਦੇ ਬਦਲੇ ਮੈਨੂੰ ਪੇਮੈਂਟ ਵਾਪਸ ਕੀਤੀ ਜਾਵੇ